ਹੈਲੋ ਵੀਰੇ ਮੇਰਾ ਨਾਮ ਹਰਚੰਦ ਸਿੰਘ ਹੈ ਅਤੇ ਮੈਂ ਹਾਂਜੀ ਮੇਰੇ ਪਿੰਡ ਹੰਡਾਏ ਤੋਂ ਬੋਲਦਾ ਜੀ ਅਤੇ ਹਾਂ ਆਪਾਂ ਫੁੱਟਵੇਅਰ ਦੀ ਦੁਕਾਨ ਤੋਂ ਬੋਲਦੇ ਹਾਂ ਜੀ ਅੱਛਾ ਜੀ ਅਸੀਂ ਨਾ ਇੱਥੋਂ ਮਤਲਬ ਸਾਡੇ ਗੁਆਂਢ ਦੇ ਵਿੱਚ ਪੰਦਰ੍ਹਾਂ ਵੀਹ ਦਿਨ ਹੋ ਗਏ ਮੈਰਿਜ ਸੀਗੀ ਜੀ ਅਤੇ ਉਹ ਮਤਲਬ ਇੱਥੋਂ ਜੁੱਤੇ ਵਗੈਰਾ ਲੈ ਕੇ ਗਏ ਸੀਗੇ ਅਤੇ ਅਸੀਂ ਮਤਲਬ ਜੁੱਤਿਆਂ ਬਾਰੇ ਗੱਲ ਕਰਨੀ ਸੀ ਆਪਣੇ ਕੋਲ ਮਿਲ ਜਾਣਗੇ ਜੀ ਅ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਹਾਂ ਹਾਂਜੀ ਹਾਂ ਅੱਛਾ ਜੀ ਅੱਛਾ ਜੀ ਅਤੇ ਮਤਲਬ ਆਪਣੇ ਕੋਲ ਹਰ ਪ੍ਰਕਾਰ ਦੇ ਮਿਲ ਜਾਂਦੇ ਆ ਜਿਵੇਂ ਬੱਚਿਆਂ ਵਾਲੇ ਬੱਚਿਆਂ ਵਾਲੇ ਵੀ ਮਿਲ ਜਾਣਗੇ ਜੀ ਮਤਲਬ ਲੇਡੀਜ ਵੀ ਮਿਲ ਜਾਂਦੇ ਲੇਡੀ

ਹਾਂਜੀ ਹਾਂਜੀ ਅੱਛਾ ਜੀ ਅੱਛਾ ਅਤੇ ਆਪਣੇ ਕੋਲ ਮਤਲਬ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਹੁੰਦੇ ਨੇ ਜੀ ਕਿਹੜੇ ਕਿਹੜੇ ਬ੍ਰੈਂਡ ਹੁੰਦੇ ਆਪਣੇ ਕੋਲ ਮਤਲਬ ਜੈਂਟਸ 'ਚ ਕਿਹੜੇ ਕਿਹੜੇ ਬ੍ਰੈਂਡ ਹੁੰਦੇ ਜੀ ਆਪਣੇ ਕੋਲ ਅੱਛਾ ਜੀ ਅੱਛਾ ਨਾਈਕੀ ਨਾਈਕੀ ਦੇ ਹਾਂਜੀ ਹਾਂਜੀ ਨਾਈਕੀ ਵਗੈਰਾ ਕੈਂਪਸ ਵੀ ਮਿਲ ਜਾਣਗੇ ਜੀ ਕੈਂਪਸ ਵਗੈਰਾ ਦੇ

ਠੀਕ ਹੈ ਜੀ ਠੀਕ ਹੈ ਮਤਲਬ ਆਪਾਂ ਨੂੰ ਬੱਚਿਆਂ ਵਾਲੇ ਵੀ ਚਾਹੀਦੇ ਨੇ ਬੱਚਿਆਂ ਵਾਲੇ ਵੀ ਮਿਲ ਜਾਣਗੇ ਜੀ ਅੱਛਾ ਜੀ ਅ ਅੱਛਾ ਜੀ ਅੱਛਾ ਅਤੇ ਆਪਾਂ ਜੇਕਰ ਜੈਂਟਸ ਦੇ ਵਿੱਚ ਆਪਾਂ ਨੂੰ ਫੋਰਮਲ ਵੀ ਮਿਲ ਜਾਣਗੇ ਜੀ ਫੋਰਮਲ ਜੇਕਰ ਲਈਏ ਤਾਂ ਅੱਛਾ ਜੀ ਅੱਛਾ ਵੈਲੀ ਵੈਲੀ ਵਗੈਰਾ ਜੀ ਵੈਲੀ ਵਗੈਰਾ ਮਤਲਬ ਜੈਂਟਸ ਦੇ ਵਿੱਚ ਹਾਂਜੀ ਹਾਂ

ਹਾਂ ਜੀ ਹਾਂ ਮਤਲਬ ਸਪੋਰਟਸ ਵਗੈਰਾ ਵੀ ਮਿਲ ਜਾਣਗੇ ਹੈ ਨਾ ਜੀ ਆਪਣੇ ਕੋਲੋਂ ਅੱਛਾ ਜੀ ਹਾਂਜੀ ਹਾਂ ਅੱਛਾ ਜੀ ਅੱਛਾ ਮਤਲਬ ਇਹਨਾਂ ਦੀ ਕੋਈ ਗਾਰੰਟੀ ਗਰੂੰਟੀ ਵੀ ਹੁੰਦੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅਤੇ ਅੱਛਾ ਜੀ ਅੱਛਾ ਆਪਣਾ ਮਤਲਬ ਇਹ ਅਡਰੈਸ ਕੀ ਹੈ ਜੀ ਆਪਣਾ ਸ਼ਾਪ ਦਾ ਅੱਛਾ ਜੀ ਸਦਰ ਬਾਜ਼ਾਰ ਸਦਰ ਬਾਜ਼ਾਰ ਦੇ ਵਿੱਚ ਜੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲੋ ਕੋਈ ਗੱਲ ਨਹੀਂ ਵੀਰ ਜੀ ਅਸੀਂ ਦੇਖ ਦਿਆਂਗੇ ਕੱਲ੍ਹ ਜਾਂ ਪਰਸੋਂ ਦੇਖ ਕੇ ਟਾਈਮ ਕੱਢ ਕੇ ਨਾ ਤੁਹਾਡੀ ਦੁਕਾਨ 'ਤੇ ਜ਼ਰੂਰ ਵਿਜ਼ਟ ਕਰਾਂਗੇ ਠੀਕ

ਅੱਛਾ ਜੀ ਦਸ ਹਜ਼ਾਰ ਦੀ ਸੌਪਿੰਗ 'ਤੇ ਤੁਸੀਂ ਗਿਫਟ ਦਿੰਦੇ ਹੋ ਜੀ ਅੱਛਾ ਜੀ ਅੱਛਾ ਚਲੋ ਕੋਈ ਗੱਲ ਨਹੀਂ ਵੀਰ ਜੀ ਅਸੀਂ ਫਿਰ ਟਾਈਮ ਕੱਢ ਕੇ ਨਾ ਤੁਹਾਡੀ ਦੁਕਾਨ 'ਤੇ ਵਿਜ਼ਟ ਕਰਦੇ ਹਾਂ ਅੱਛਾ ਜੀ ਠੀਕ ਹੈ ਵੀਰ ਜੀ ਓਕੇ ਵੀਰ ਜੀ ਧੰਨਵਾਦ ਓਕੇ ਵੀਰ ਜੀ